ਸਮੇਂ ਦੇ ਨਾਲ ਨਾਲ ਪੰਜਾਬ ਦੀ ਜਨਸੰਖਿਆ ਕਾਫੀ ਬਦਲੀ ਹੈ ਇਸ ਵਿੱਚ ਕਾਫੀ ਹੀ ਬਦਲਾਵ ਆ ਗਿਆ ਹੈ ਅਸੀਂ ਅੱਜ ਦੇ ਜ਼ਮਾਨੇ ਵਿੱਚ ਦੇਖਦੇ ਹਾਂ ਕਿ ਪਿੰਡਾਂ ਦੇ ਲੋਕ ਸ਼ਹਿਰਾਂ ਵੱਲ ਨੂੰ ਆਉਂਦੇ ਨੇ ਕਿਉਂਕਿ ਉਹਨਾਂ ਨੂੰ ਉੱਥੇ ਆਪਣਾ ਵਧੀਆ ਰੁਜ਼ਗਾਰ ਨਹੀਂ ਮਿਲਦਾ ਉਹ ਸ਼ਹਿਰਾਂ ਵਿੱਚ ਆ ਕੇ ਵਸਣ ਲੱਗ ਪਏ ਨੇ ਅਤੇ ਇੱਥੇ ਵਧੀਆ ਆਪਣਾ ਕਮਾਈ ਕਰਦੇ ਨੇ ਕਈ ਮੈਂ ਦੇਖਦੀ ਹਾਂ ਮੈਂ ਕਾਲਜ ਵਿੱਚ ਪੜ੍ਹਦੀ ਹਾਂ ਅਤੇ ਮੈਂ ਦੇਖਦੀ ਹਾਂ ਮੇਰੇ ਕਈ ਫਰੈਂਡਸ ਪਿੰਡਾਂ ਦੇ ਹਨ ਉਹ ਸ਼ਹਿਰ ਵਿੱਚ ਨਹੀਂ ਰਹਿੰਦੇ ਪਰ ਉਹ ਆਪਣੀ ਪੜ੍ਹਾਈ ਦੇ ਖਾਤਰ ਆਪਣੇ ਪਰਿਵਾਰਾਂ ਨਾਲ ਰੁਜ਼ਗਾਰ ਕਰਨ ਲਈ ਸ਼ਹਿਰ ਵਿੱਚ ਆ ਜਾਂਦੇ ਨੇ ਅਤੇ ਨਾਲ ਨਾਲ ਪੜ੍ਹਦੇ ਨੇ ਨਾਲ ਨਾਲ ਕੰਮ ਵੀ ਕਰਦੇ ਨੇ ਆਪਣੇ ਪਰਿਵਾਰ ਦਾ ਸਾਥ ਦੇਣ ਲਈ ਅਤੇ ਇਸ ਲਈ ਕਾਫੀ ਹੀ ਪੰਜਾਬੀ ਵਿੱਚ ਬਦਲਾਅ ਆ ਚੁੱਕਾ ਹੈ ਅਤੇ ਕਾਫੀ ਨਾ ਸਿਰਫ ਪਿੰਡਾਂ ਤੋਂ ਬਲਕਿ ਪੰਜਾਬ ਤੋਂ ਬਾਹਰ ਜਿਹੜੇ ਰਾਜ ਨੇ ਉੱਥੋਂ ਵੀ ਕਈ ਜਿਹੜੇ ਵਿਅਕਤੀ ਨੇ ਲੋਕ ਨੇ ਉਹ ਪੰਜਾਬ ਆਉਂਦੇ ਨੇ ਕਈ ਖੇਡ ਖੇਡਣ ਲਈ ਪੰਜਾਬ ਆਉਂਦੇ ਨੇ ਕਿਉਂਕਿ ਪੰਜਾਬ ਦੇ ਜ਼ਿਲ੍ਹੇ ਪਟਿਆਲੇ ਵਿੱਚ ਐੱਨ ਆਈ ਐੱਸ ਹੈ ਅਤੇ ਇ ਕਿਉਂਕਿ ਇਸ ਵਿੱਚ ਕਾਫੀ ਸਾਰੀਆਂ ਤਰੀਕੇ ਦੀਆਂ ਖੇਡਾਂ ਖੇਡੀਆਂ ਜਾਂਦੀਆਂ ਨੇ ਕਾਫੀ ਸਾਰੇ ਕੋਂਪੀਟੀਸ਼ਨਸ ਕਰੇ ਜਾਂਦੇ ਨੇ ਜਿਨ੍ਹਾਂ ਨੂੰ ਖੇਡਾਂ ਵਿੱਚ ਵੀ ਰੁਝਾਨ ਹੁੰਦਾ ਉਹ ਇੱਥੇ ਪਿੰਡਾਂ ਤੋਂ ਸ਼ਹਿਰਾਂ ਵੱਲ ਆਉਂਦੇ ਨੇ ਅਤੇ ਬਹੁਤ ਹੀ ਜ਼ਿਆਦਾ ਖੇਡਾਂ ਵਿੱਚ ਆਪਣੀ ਤਰੱਕੀ ਕਰਦੇ ਨੇ ਬਹੁਤ ਸਾਰੇ ਮੈਡਲ ਜਿੱਤ ਕੇ ਜਾਂਦੇ ਨੇ